ਛੋਟੇ ਕਾਰੋਬਾਰ ਦਾ ਕੰਮ ਕੀ ਹੁੰਦਾ ਹੈ ਇਸ ਕਰਕੇ ਛੋਟੇ ਕਾਰੋਬਾਰ ਛੋਟੇ ਛੋਟੀਆਂ ਫੈਕਟਰੀਆਂ ਵਿੱਚ ਹੁੰਦੇ ਹਨ ਉਹ ਇਸ ਕਰਕੇ ਪੜ੍ਹੇ ਲਿਖੇ ਹਨ ਤਾਂ ਪੜ੍ਹਿਆ ਲਿਖਿਆ ਨੂੰ ਉਹੋ ਜਿਹਾ ਕੰਮ ਮਿਲ ਜਾਂਦਾ ਹੈ ਜੋ ਅਨਪੜ੍ਹ ਹਨ ਉਹਨਾਂ ਨੂੰ ਵੀ ਕੰਮ ਮਿਲ ਜਾਂਦਾ ਹੈ ਛੋਟੇ ਕਾਰੋਬਾਰ ਦਾ ਮਤਲਬ ਇਹ ਹੁੰਦਾ ਹੈ ਕਿ ਛੋਟੀਆਂ ਫੈਕਟਰੀਆਂ ਹੁੰਦੀਆਂ ਹਨ ਛੋਟੇ ਆਮ ਪਿਡ ਆਮ ਸ਼ਹਿਰਾਂ ਵਿੱਚ ਹੁੰਦੀਆਂ ਹਨ ਜੋ ਕਿ ਵੱਡੇ ਸ਼ਹਿਰਾਂ ਵਿੱਚ ਤਾਂ ਵੱਡਾ ਕਾਰੋਬਾਰ ਹੁੰਦਾ ਛੋਟੇ ਸ਼ਹਿਰਾਂ ਵਿੱਚ ਛੋਟਾ ਕਾਰੋਬਾਰ ਹੁੰਦਾ ਇਸ ਕਰਕੇ ਆਪਾਂ ਨੂੰ ਛੋਟੀਆਂ ਫੈਕਟਰੀਆਂ ਵਿੱਚ ਹੀ ਛੋਟਾ ਕਰ ਜਿਹੇ ਜਹੇ ਪੜ੍ਹੇ ਲਿਖੇ ਨੌਜਵਾਨ ਜਾ ਕੇ ਅਨਪੜ ਹੁੰਦੇ ਹਨ ਉਹਨਾਂ ਨੂੰ ਉਹੋ ਜਿਹਾ ਹੀ ਕੰਮ ਦਿੱਤਾ ਜਾਂਦਾ ਹੈ ਛੋਟੇ ਕਾਰੋਬਾਰ ਦਾ ਮਤਲਬ ਇਹ ਹੈ ਕਿ ਆਪਾਂ ਨੂੰ ਛੋਟਾ ਹੀ ਛੋਟਾ ਕਾਰੋਬਾਰ ਜਿੱਥੇ ਹੈ ਉੱਥੇ ਹੀ ਆਪਾਂ ਨੂੰ ਲੱਗਣਾ ਚਾਹੀਦਾ ਹੈ ਜਿਹੋ ਜਿਹਾ ਪੜ੍ਹੇ ਲਿਖੇ ਹਨ ਤਾਂ ਉਹ ਜ਼ਿਆਦਾ ਵਧੀਆ ਤਨਖਾਹਾਂ ਪਾਉਂਦੇ ਹਨ ਜਿਹੜੇ ਛੋਟੇ ਘੱਟ ਪੜ੍ਹੇ ਹੁੰਦੇ ਹਨ ਉਹ ਘੱਟ ਤਨਖਾਹਾਂ ਪਾਉਂਦੇ ਹਨ ਇਸ ਕਰਕੇ ਆਪਾਂ ਨੂੰ ਛੋਟੇ ਕਾਰੋਬਾਰ ਦਾ ਇਹ ਹੀ ਮਤਲਬ ਹੈ